ਸਿੱਖਿਆ ਨੇ ਸੱਭਿਆਚਾਰਕ ਅਭਿਆਸ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਇਸਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸਾਂਭ ਸੰਭਾਲ ਪਰ ਸ਼ਾਨ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਵਿੱਚ ਯੋਗਦਾਨ ਪਾਇਆ ਹੈ ਇਸ ਦੇ ਇਲਾਵਾ ਖੇਤੀਬਾੜੀ ਸਿੱਖਿਆ ਨੇ ਖੇਤੀ ਦੇ ਤਰੀਕਿਆਂ ਦਾ ਆਧੁਨਿਕੀਕਰਨ ਕੀਤਾ ਜਿਸ ਨਾਲੋਂ ਉਤਪਾਦ ਬਹੁਤ ਵੱਧ ਗਏ ਨੇ ਜਿਵੇਂ ਕਿ ਲੋਕ ਸਿੱਖਿਆ ਤੱਕ ਪਹੁੰਚ ਪ੍ਰਾਪਤ ਕਰਦੇ ਨੇ ਪਰੰਪਰਾਗਤ ਸਮਾਜਿਕ ਨਿਯਮ ਵਿਕਸਿਤ ਹੋ ਜਾਂਦੇ ਨੇ ਵਿਆਹ ਦੇ ਪੈਟਰਾਂ ਨੇ ਪੈਟਰਨਾਂ ਅਤੇ ਭਾਈਚਾਰਕ ਗਤੀਸ਼ੀਲਤਿਆਂ ਨੂੰ ਪ੍ਰਭਾਵਿਤ ਕੀਤਾ ਹੈ ਇਸ ਤੋਂ ਬਿਨਾਂ ਕਿਲ ਮਿਲਾ ਕੇ ਸਿੱਖਿਆ ਸੱਭਿਆਚਾਰਿਕ ਜੜਾਂ ਨੂੰ ਸੁਰੱਖਿਅਤ ਰੱਖਣ ਅਤੇ ਪੰਜਾਬ ਦੇ ਸੱਭਿਆਚਾਰਕ ਲੈਂਡ ਸਕਾਅ ਵਿੱਚ ਪਰਿਵਰਤਨਸ਼ੀਲ ਤਬਦੀਲੀਆਂ ਦੀ ਸ਼ੁਰੂਆਤ ਕਰਨ ਲਈ ਉਤਪ੍ਰੇਰਕ ਵਜੋਂ ਕੰਮ ਕਰਦੀ ਏ ਪਰੰਤੂ ਨਾਲ ਨਾਲ ਅਸੀਂ ਵਿਦੇਸ਼ੀ ਪਹਿਰਾਵਾ ਵੀ ਆਪਣਾ ਰਹੇ ਹਾਂ ਅੱਜ ਲੋਕਾਂ ਦਾ ਮੰਨਣਾ ਇਹ ਹੈ ਕਿ ਜੋ ਵਿਦੇਸ਼ੀ ਪ੍ਰਭਾਵ ਨੂੰ ਕਬੂਲਦੇ ਹਨ ਉਹੀ ਕਾਮਯਾਬ ਹਨ ਅਤੇ ਉਹੀ ਪੜ੍ਹੇ ਲਿਖੇ ਹਨ ਲੋਕਾਂ ਨੂੰ ਉਹਨਾਂ ਦੇ ਕੱਪੜਿਆਂ ਨਾਲ ਜੱਜ ਕੀਤਾ ਜਾਂਦਾ ਹੈ ਜਿਸ ਨਾਲ ਕਿ ਸੱਭਿਆਚਾਰਕ ਵਿਦੇਸ਼ੀ ਚੀਜ਼ਾਂ ਨੂੰ ਅਪਣਾਉਣ ਲੱਗ ਅਪਣਾਉਣ ਲੱਗਾ ਹੈ ਲੋੜ ਹੈ ਇਸ ਤੋਂ ਉੱਪਰ ਉੱਠਣ ਦੀ ਸਭ ਕੁਝ ਪੰਜਾਬੀਅਤ ਨਾਲ ਵੇਖਣ ਦੀ